ਮੇਰਾ ਨਾਮ ਅੰਗਰੇਜ਼ ਸਿੰਘ ਪਿੰਡ ਤਾਲਾ ਜ਼ਿਲ੍ਹਾ ਬਰਨਾਲਾ ਜੋ ਕਿ ਅਸੀਂ ਦੋ ਹਜ਼ਾਰ ਬਾਈ ਦੇ ਵਿੱਚ ਰੇਲ ਗੱਡੀ ਦੀ ਯਾਤਰਾ ਕੀਤੀ ਰੇਲ ਗੱਡੀ ਦੀ ਯਾਤਰਾ ਕਰਨ ਲਈ ਸਾਨੂੰ ਪਹਿਲਾਂ ਬਰਨਾਲਾ ਸਟੈਸ਼ਨ ਵਿਸੇ ਵਿਖੇ ਜਾ ਕੇ ਸਾਨੂੰ ਰੇਲ ਗੱਡੀ ਦੀ ਟਿਕਟ ਬੁੱਕ ਕਰਵਾਉਣੀ ਪਈ ਰੇਲ ਗੱਡੀ ਦੀ ਟਿਕਟ ਬੁਕਿੰਗ ਕਰਵਾ ਕੇ ਰੇਲ ਗੱਡੀ ਦੀ ਵੇਟ ਕੀਤੀ ਰੇਲ ਗੱਡੀ ਦੀ ਵੇਟ ਕਰਨ ਸਾਰ ਜੋ ਕਿ ਰੇਲ ਗੱਡੀ ਬਰਨਾਲਾ ਸਟੇਸ਼ਨ 'ਤੇ ਪਹੁੰਚ ਗਈ ਸੀ ਜੋ ਕਿ ਅਸੀਂ ਮੈਂ ਔਰ ਮੇਰਾ ਪਰਿਵਾਰ ਰੇਲ ਗੱਡੀ ਦੇ ਵਿੱਚ ਬਹਿ ਕੇ ਸ਼੍ਰੀ ਹਰਿਮੰਦਰ ਸਾਹਿਬ ਜਾਣਾ ਸੀ ਕਿਉਂਕਿ ਪਹਿਲਾਂ ਅਸੀਂ ਧੂਰੀ ਧੂਰੀ 'ਤੇ ਪਹੁੰਚ ਕੇ ਅਸੀਂ ਟਰੇਨ ਜੋ ਕਿ ਰੇਲ ਗੱਡੀ ਬਦਲੀ ਉਥੋਂ ਅਸੀਂ ਟਿਕਟ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਜਾਣ ਲਈ ਟਿਕਟ ਲੈਤੀ ਕਿਉਂਕਿ ਰੇਲ ਗੱਡੀ ਦੇ ਵਿੱਚ ਬਹੁਤ ਵਧੀਆ ਸੀਟਾਂ ਔਰ ਬਹੁਤ ਹੀ ਸਾਫ ਸੁਥਰਾ ਡੱਬਾ ਸੀ ਜੋ ਕਿ ਅਸੀਂ ਹਰਿਮੰਦਰ ਸਾਹਿਬ ਪਹੁੰਚੇ ਹਰਿਮੰਦਰ ਸਾਹਿਬ ਤੋਂ ਦਰਸ਼ਨ ਕਰਕੇ ਮੈਂ ਔਰ ਮੇਰਾ ਪਰਿਵਾਰ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਤੋਂ ਯਾਤਰਾ ਕਰਕੇ ਅਸੀਂ ਹਜ਼ੂਰ ਸਾਹਿਬ ਕਨੀ ਟਰੇਨ ਫੜੀ ਔਰ ਅਸੀਂ ਉਥੋਂ ਸਟੇਸ਼ਨ ਤੋਂ ਚੜ੍ਹੇ ਸ਼੍ਰੀ ਹਜੂਰ ਸਾਹਿਬ ਨੂੰ ਕਿਉਂਕਿ ਅਸੀਂ ਰੇਲ ਗੱਡੀ ਦੇ ਵਿੱਚ ਸਫਰ ਕਰ ਰਹੇ ਸੀ ਰੇਲ ਗੱਡੀ ਦੇ ਵਿੱਚ ਸਫਰ ਕਰਦੇ ਕਰਦੇ ਸ਼੍ਰੀ ਅਸੀਂ ਹਜੂਰ ਸਾਹਿਬ ਪਹੁੰਚ ਗਏ ਸੀਗੇ ਹਜੂਰ ਸਾਹਿਬ ਤੋਂ ਦਰਸ਼ਨ ਕਰਕੇ ਜੋ ਕਿ ਅਸੀਂ ਜੋ ਕਿ ਅਸੀਂ ਹਜੂਰ ਸਾਹਿਬ ਤੋਂ ਦਰਸ਼ਨ ਕਰਕੇ ਅਸੀਂ ਸ਼੍ਰੀ ਹਰਿਦੁਆਰ ਕੰਨੀ ਚਲੇ ਗਏ ਸੀਗੇ ਉਥੋਂ ਅਸੀਂ ਦਰਸ਼ਨ ਕਰਕੇ ਅਸੀਂ ਆਪਦਾ ਘਰ ਆਉਣ ਲਈ ਸੋਚਿਆ ਤਾਂ ਅਸੀਂ ਘਰ ਰੇਲ ਗੱਡੀ 'ਤੇ ਵਾਪਸ ਹੀ ਆਪਣੇ ਘਰ ਪਹੁੰਚ ਗਏ ਸਨ